ਪੰਜ ਮਾਰਚ ਉੱਨੀ ਸੌ ਸਤੱਤਰ ਅੱਠ ਜੂਨ ਉੱਨੀ ਸੌ ਅਠਾਨਵੇਂ ਇੱਕੀ ਅਕਤੂਬਰ ਦੋ ਹਜ਼ਾਰ ਪੰਜ ਚੌਵੀ ਨਵੰਬਰ ਦੋ ਹਜ਼ਾਰ ਦਸ ਪੱਚੀ ਦਸੰਬਰ ਦੋ ਹਜ਼ਾਰ ਵੀਹ